ਹਾਂਜੀ ਮੈਂ ਡਾਂਸ ਰੀਲਾਂ ਦੇਖਦੀ ਹਾਂ ਬਹੁਤ ਜ਼ਿਆਦਾ ਸ਼ੋਰਟਸ ਵੀ ਵੇਖਦੀ ਹਾਂ ਡਾਂਸ ਰੀਲਾਂ ਜਦੋਂ ਮੈਂ ਜਦੋਂ ਫੋਨ ਦੇਖਦੀ ਹਾਂ ਔਰ ਉਹਦੇ ਵਿੱਚ ਬੜੇ ਤਰ੍ਹਾਂ ਦੇ ਡਾਂਸ ਆਉਂਦੇ ਹਨ ਰੀਲਾਂ ਆਉਂਦੀਆਂ ਰੀਲਾਂ ਦੇਖਦੇ ਦੇਖਦੇ ਸਾਡਾ ਟਾਈਮ ਹੀ ਪਤਾ ਨਹੀਂ ਕਿੱਥੇ ਚੱਲ ਜਾਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਘੰਟਾ ਵੇਖ ਲਿਆ ਪ ਦਸ ਮਿੰਟ ਫੋਨ ਨੂੰ ਹੱਥ ਲਾਉ ਤਾਂ ਦੋ ਦੋ ਘੰਟੇ ਲੱਗ ਜਾਂਦੇ ਆ ਡਾਂਸ ਰੀਲਾਂ ਦੇ ਵਿੱਚ ਬੜੇ ਤਰ੍ਹਾਂ ਦੇ ਬੱਚਿਆਂ ਦੇ ਡਾਂਸ ਦੇਖੇ ਜਾਂਦੇ ਹਨ ਰੀਲਾਂ ਐਨੀਆਂ ਸੋਹਣੀਆਂ ਸੋਹਣੀਆਂ ਆਉਂਦੀਆਂ ਹਨ ਜਿਹਦੇ ਵਿੱਚ ਭਗਤੀ ਦੇ ਵੀ ਕਈ ਆਉਂਦੇ ਹਨ ਜਿਵੇਂ ਸਕੋਨ ਮੰਦਰ ਤੋਂ ਜਿਹੜੇ ਹਰੇ ਕ੍ਰਿਸ਼ਨਾ ਵਾਲੇ ਹੈਗੇ ਨੇ ਹਰੇ ਕ੍ਰਿਸ਼ਨਾ ਉਹਨਾਂ ਦਾ ਮਹਾਂ ਮੰਤਰ ਹੈਗਾ ਉਹਦੇ 'ਤੇ ਵੀ ਬੜੇ ਡਾਂਸ ਉਹਦੇ ਵਿੱਚ ਵੀ ਡਾਂਸ ਇੱਡਾ ਸੋਹਣਾ ਹੁੰਦਾ ਕਿ ਡਾਂਸ 'ਤੇ ਅਸੀਂ ਉਹਨਾਂ ਦੇ ਨਾਲ ਹੀ ਆਪਣਾ ਆਹ ਵੀ ਨੱਚਣਾ ਸ਼ੁਰੂ ਕਰ ਦਿੰਦੇ ਹਾਂ ਉਹਨਾਂ ਦਾ ਕਿਤੇ ਕੀਰਤਨ ਹੁੰਦਾ ਹੋਵੇ ਉ ਨਾਲ ਹੀ ਲਾਈਵ ਪਾਉਂਦੇ ਹਨ ਡਾਂਸ ਦੀਆਂ ਰੀਲਾਂ ਪਾਉਂਦੇ ਹਨ ਇੰਸਟਾਗਰਾਮ ਦੇ ਉੱਤੇ ਉਹਦੇ ਵਿੱਚ ਵੀ ਅਸੀਂ ਬਹੁਤ ਸਾਰੀ ਸ਼ੋਰਟਸ ਵੀ ਵੇਖਦੇ ਹਾਂ ਉਹਨਾਂ ਦੇ ਕਈ ਵਾਰੀ ਭਗਤੀ ਦੇ ਉੱਤੇ ਵੀ ਦਿੱਤੇ ਜਾਂਦੇ ਹਨ ਸ਼ੋਰਟਸ ਅਸੀਂ ਉਹ ਵੀ ਵੇਖਦੇ ਹਾਂ ਸ਼ੋਸ਼ਲ ਮੀਡੀਆ ਦੇ ਉੱਤੇ ਮੇਰਾ ਸਭ ਤੋਂ ਜ਼ਿਆਦਾ ਪਸੰਦ ਪਸੰਦੀਦਾ ਜਿਹੜਾ ਡਾਂਸਰ ਹੈ ਉਹ ਵੈਸੇ ਤਾਂ ਹੈਗਾ ਵੈ ਧਨ ਸ਼੍ਰੀ ਵਰਮਾ ਕਿਉਂਕਿ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਉਹਦਾ ਡਾਂਸ ਬਹੁਤ ਜ਼ਿਆਦਾ ਪਸੰਦ ਹੈ ਉਹ ਤਾਂ ਡਾਂਸ ਹੀ ਬਹੁਤ ਸੋਹਣਾ ਕਰਦਾ ਹੈ ਅਤੇ ਉਹਦੀਆਂ ਰੀਲਾਂ ਵੀ ਬਹੁਤ ਸੋਹਣੀਆਂ ਹਨ ਹੋਰ ਵੀ ਬੜੇ ਤਰ੍ਹਾਂ ਦੀਆਂ ਛੋਟੇ ਛੋਟੇ ਬੱਚੇ ਵੀ ਅੱਜ ਕੱਲ੍ਹ ਬੜੇ ਸੋਹਣੇ ਸੋਹਣੇ ਰੀਲਾਂ ਬਣਾਉਂਦੇ ਹਨ ਅਤੇ ਦੇਖ ਕੇ ਮਨ ਖੁਸ਼ ਹੋ ਜਾਂਦਾ ਕਈ ਭਗਤੀ ਦੇ ਉੱਤੇ ਬਣਾਉਂਦੇ ਹਨ ਕਈ ਡਾਂਸ ਦੇ ਉੱਤੇ ਬਣਾਉਂਦੇ ਹਨ ਕਈ ਸ਼ੋਰਟਸ ਬਣਾਉਂਦੇ ਹਨ ਛੋਟੇ ਛੋਟੇ ਬਸ ਬਣਾਈ ਜਾਂਦੇ ਹਨ ਅਤੇ ਅਸੀਂ ਦੇਖੀ ਜਾਂਦੇ ਹਾਂ